ਮਨੁੱਖ ਦੇ ਜੀਵਨ ਵਿੱਚ ਸਰੋਤਾਂ ਦਾ ਬਹੁਤ ਹੀ ਮਹੱਤਵਪੂਰਨ ਸਥਾਨ ਹੈ ਹਵਾ ਪਾਣੀ ਮਿੱਟੀ ਸੂਰਜ ਦੀ ਗਰਮੀ ਅਤੇ ਹੋਰ ਅਨੇਕ ਜਿਹੜੇ ਸਰੋਤ ਨੇ ਉਹ ਮਨੁੱਖ ਦੇ ਜੀਵਨ ਵਿੱਚ ਆਪਣਾ ਮਹੱਤਵਪੂਰਨ ਸਥਾਨ ਰੱਖਦੇ ਹਨ ਅਗਰ ਇਹ ਜਿੰਨੇ ਵੀ ਸਰੋਤ ਨੇ ਇੱਕ ਸਹੀ ਮਾਤਰਾ ਵਿੱਚ ਧਰਤੀ ਉੱਤੇ ਹੋਣਗੇ ਤਾਂ ਹੀ ਜਿਹੜਾ ਮਨੁੱਖ ਦਾ ਜੀਵਨ ਆ ਉਹ ਸਫ਼ਲ ਹੋ ਸਕਦਾ ਅਗਰ ਇਹ ਜਿੰਨੇ ਨੇ ਸਰੋਤ ਨੇ ਅਗਰ ਇਹ ਧਰਤੀ ਉੱਤੇ ਸਹੀ ਮਾਤਰਾ ਵਿੱਚ ਨਹੀਂ ਹੋਣਗੇ ਤਾਂ ਮਨੁੱਖ ਦਾ ਜੀਵਨ ਸਫ਼ਲ ਨਹੀਂ ਹੋ ਸਕਦਾ ਮਨੁੱਖ ਦੀਆਂ ਜਿਹੜੀਆਂ ਵਿਗਿਆਨਿਕ ਗਤੀਵਿਧੀਆਂ ਵਾਂ ਉਹਦੇ ਕਰਕੇ ਜਿਹੜੇ ਸਰੋਤ ਨੇ ਹੌਲੀ ਹੌਲੀ ਕਰਕੇ ਖ਼ਤਮ ਹੋ ਰਹੇ ਨੇ ਖ਼ਰਾਬ ਵੀ ਹੋ ਰਹੇ ਨੇ ਜਿਹਦੇ ਨਾਲ ਪ੍ਰਦੂਸ਼ਣ ਹੁੰਦਾ ਪਿਆ ਵਾ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋ ਰਹੀਆਂ ਨੇ ਜਿੱਦਾਂ ਹੁਣ ਹਵਾ ਦਾ ਪ੍ਰਦੂਸ਼ਣ ਹੋ ਰਿਹਾ ਹੈ ਪਾਣੀ ਦਾ ਪ੍ਰਦੂਸ਼ਣ ਹੋ ਰਿਹਾ ਅਤੇ ਹੋਰ ਵੀ ਕਈ ਤਰ੍ਹਾਂ ਦੇ ਪ੍ਰਦੂਸ਼ਣ ਹੋ ਰਹੇ ਨੇ ਜਿੱਦਾਂ ਕਿ ਹੁਣ ਮਨੁੱਖ ਪਾਣੀ ਦੀ ਕਮੀ ਆ ਜਿਹੜਾ ਪਾਣੀ ਆ ਉਹ ਮਨੁੱਖ ਦੇ ਜੀਵਨ ਵਿੱਚ ਇੱਕ ਮਹੱਤਵਪੂਰਨ ਸਥਾਨ ਰੱਖਦਾ ਪਰ ਜਿਹੜਾ ਮਨੁੱਖ ਆ ਉਹ ਪਾਣੀ ਦਾ ਸਹੀ ਢੰਗ ਦੇ ਨਾਲ ਵਰਤੋਂ ਨਹੀਂ ਕਰਦਾ ਜਿੱਦਾਂ ਕਿ ਹੁਣ ਅੱਜ ਕੱਲ੍ਹ ਅ ਸੀਵਰੇਜ਼ ਨੇ ਉਹਨਾਂ ਦਾ ਜਿੰਨਾ ਵੀ ਪਾਣੀ ਆ ਉਹ ਸਾਰਾ ਨਹਿਰਾਂ ਅਤੇ ਦਰਿਆਵਾਂ ਦੇ ਵਿੱਚ ਸੁੱਟਿਆ ਜਾ ਰਿਹਾ ਜਿਹਦੇ ਕਾਰਨ ਜਿਹੜੇ ਉਹਨਾਂ ਦਾ ਨਹਿਰਾਂ ਅਤੇ ਦਰਿਆਵਾਂ ਦਾ ਜਿਹੜਾ ਪਾਣੀ ਆ ਉਹ ਕੀ ਹੋ ਰਿਹਾ ਖ਼ਰਾਬ ਹੋ ਰਿਹਾ ਵਾ ਮਿੱਟੀ ਹੈ ਹੁਣ ਪਾਣੀ ਦੇ ਇਲਾਵਾ ਜਿਹੜੀ ਮਿੱਟੀ ਹੈ ਉਹਦਾ ਵੀ ਇੱਕ ਮਹੱਤਵਪੂਰਨ ਸਥਾਨ ਆ ਮਨੁੱਖ ਦੇ ਜੀਵਨ ਵਿੱਚ ਜਿਹੜਾ ਮਨੁੱਖ ਆ ਉਹ ਕੀ ਕਰਦਾ ਕਈ ਪ੍ਰਕਾਰ ਦੇ ਉਹਦੇ ਜਿਹੜੇ ਰਸਾਇਣਿਕ ਚੀਜ਼ਾਂ ਹੁੰਦੀਆਂ ਉਹਨਾਂ ਨੂੰ ਮਿੱਟੀ ਦੇ ਵਿੱਚ ਸੁੱਟ ਦਿੰਦਾ ਜਿੱਦਾਂ ਕਿ ਅਸੀਂ ਕਦੀ ਕਦੀ ਆਪਣੇ ਘਰ ਦਾ ਕੂੜਾ ਕਚਰਾ ਵੀ ਮਿੱਟੀ ਵਿੱਚ ਸੁੱਟ ਦਿੰਦੇ ਹਾਂ ਪਲਾਸਟਿਕ ਦੇ ਲਿਫ਼ਾਫੇ ਬੋਤਲਾਂ ਲੋਹੇ ਦੇ ਸਮਾਨ ਹੋਰ ਵੀ ਕਈ ਕੁਝ ਚੀਜ਼ਾਂ ਜਿਹੜੀਆਂ ਅਸੀਂ ਮਿੱਟੀ ਵਿੱਚ ਸੁੱਟ ਦਿੰਦੇ ਹਾਂ ਜਿਹਦੇ ਕਾਰਨ ਜਿਹੜੀ ਮਿੱਟੀ ਆ ਉਹ ਕੀ ਹੋ ਰਹੀ ਹੈ ਪ੍ਰਦੂਸ਼ਿਤ ਹੋ ਰਹੀ ਹੈ ਅਤੇ ਹੋਰ ਵੀ ਕਈ ਜ਼ਿਆਦਾ ਬਿਮਾਰੀਆਂ ਲੱਗ ਰਹੀਆਂ ਨੇ ਧਰਤੀ ਦੇ ਉੱਤੋਂ ਜਦੋਂ ਜੰਗਲ ਨੂੰ ਉਹਨਾਂ ਨੂੰ ਕੱਟਿਆ ਜਾਂਦਾ ਅਤੇ ਕਾਰਖਾਨੇ ਲਗਾਏ ਜਾਂਦੇ ਆ ਜਿਹਦੇ ਕਾਰਨ ਜਿਹੜੀ ਕਾਰਬਨ ਡਾਈਔਕਸਾਈਡ ਹੈ ਉਹ ਕੀ ਹੋ ਰਹੀ ਆ ਵੱਧ ਰਹੀ ਹੈ ਅਤੇ ਧਰਤੀ ਦੇ ਉੱਤੇ ਜਿਹੜੀ ਗਰਮੀ ਆ ਉਹ ਵੱਧ ਰਹੀ ਹੈ ਅਤੇ ਹਵਾ ਵਾ ਜਿਹੜੀ ਉਹ ਬਹੁਤ ਹੀ ਜ਼ਿਆਦਾ ਜ਼ਹਿਰੀਲੀ ਵੀ ਹੋ ਰਹੀ ਹੈ ਜਿਹੜੇ ਜੰਗਲ ਆ ਉਹਨਾਂ ਦੇ ਕੱਟਣ ਦੇ ਨਾਲ ਜਿਹੜੇ ਜੀਵਾਂ ਅਤੇ ਪਕਸ਼ੀਆ ਦਾ ਜਿਹੜਾ ਨੁਕਸਾਨ ਆ ਉਹ ਕਾਫੀ ਜ਼ਿਆਦਾ ਹੋ ਰਿਹਾ ਵਾ ਇਸ ਕਰਕੇ ਜਿਹੜੇ ਸਾਨੂੰ ਪਾਣੀ ਆ ਉਹਨੂੰ ਵੀ ਉਹਦੀ ਵੀ ਸਾਂਭ ਸੰਭਾਲ ਕਰਨੀ ਚਾਹੀਦੀ ਹੈ ਜਿਹੜਾ ਜਿੰਨਾ ਸਾਨੂੰ ਪਾਣੀ ਦੀ ਜ਼ਰੂਰਤ ਹੋਵੇ ਓਨਾ ਹੀ ਵਰਤਣਾ ਚਾਹੀਦਾ ਵੱਧ ਪਾਣੀ ਦੀ ਸਾਨੂੰ ਵਰਤੋਂ ਨਹੀਂ ਕਰਨੀ ਚਾਹੀਦੀ ਕਿਉਂਕਿ ਪਾਣੀ ਦੀ ਜਿਹੜਾ ਪਾਣੀ ਆ ਉਹ ਸਾਡੇ ਜੀਵਨ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਜਿੱਦਾਂ ਕਿ ਹੁਣ ਦਰੱਖਤ ਆ ਉਹਨਾਂ ਨੂੰ ਵੀ ਸਾਨੂੰ ਨਹੀਂ ਕੱਟਣਾ ਚਾਹੀਦਾ ਉਹਨਾਂ ਦੇ ਕੱਟਣ ਦੇ ਨਾਲ ਕਾਰਬਨ ਡਾਈਆਕਸਾਈਡ ਵੱਧਦੀ ਆ ਅਤੇ ਆਕਸੀਜਨ ਘੱਟ ਜਾਂਦੀ ਆ ਸਾਨੂੰ ਵੱਧ ਤੋਂ ਵੱਧ ਦਰੱਖਤ ਲਗਾਉਣੇ ਚਾਹੀਦੇ ਸਨ ਹਨ ਸਾਨੂੰ ਆਪਣੇ ਸਕੂਲਾਂ ਵਿੱਚ ਵੀ ਕਾਫੀ ਦਰੱਖਤ ਲਗਾਉਣੇ ਚਾਹੀਦੇ ਹਨ ਜਦੋਂ ਕਿਸੇ ਦਾ ਜਨਮ ਦਿਨ ਹੁੰਦਾ ਤਾਂ ਸਾਨੂੰ ਉਹਨੂੰ ਮਹਿੰਗੇ ਤੋਂ ਮਹਿੰਗੇ ਤੋਹਫੇ ਦੇਣ ਦੀ ਜਗ੍ਹਾ 'ਤੇ ਇੱਕ ਬੂਟਾ ਗਿਫਟ ਕਰਨਾ ਚਾਹੀਦਾ ਹੈ ਕਿ ਜਿਹੜਾ ਕਿ ਉਹ ਲਗਾ ਲਵੇ ਅਤੇ ਮਨੁੱਖ ਦਾ ਜੀਵਨ ਵੀ ਇੱਕ ਸਫ਼ਲ ਜੀਵਨ ਬਣ ਸਕੇ ਅਤੇ ਸਾਨੂੰ ਇਹ ਸਾਰੇ ਸਰੋਤ ਸਾਡੇ ਜੀਵਨ ਵਿੱਚ ਬਹੁਤ ਹੀ ਜ਼ਿਆਦਾ ਜ਼ਰੂਰੀ ਹਨ